ਇੱਕ ਅਪ੍ਰੈਲ ਦੋ ਹਜ਼ਾਰ ਚਾਰ ਸੱਤ ਅਪ੍ਰੈਲ ਦੋ ਹਜ਼ਾਰ ਤਿੰਨ ਸਤਾਈ ਮੇਅ ਦੋ ਹਜ਼ਾਰ ਇੱਕ ਤਿੰਨ ਦਸੰਬਰ ਦੋ ਹਜ਼ਾਰ ਤਿੰਨ ਤੇਰਾਂ ਦਸੰਬਰ ਦੋ ਹਜ਼ਾਰ ਤਿੰਨ